ਪੰਜਾਬ ਵਿੱਚ ਜਿਹੜੇ ਬੈਂਕਿੰਗ ਅਤੇ ਬੀਮਾ ਖੇਤਰ ਹੈ ਉਹ ਉੱਚ ਆਪਣੀ ਜਿਹੜੀ ਹੁਨਰ ਨੂੰ ਕਿਵੇਂ ਆਕਰਸ਼ਿਤ ਕਰਦੇ ਹੈ ਬਹੁਤ ਸਾਰੇ ਤਰੀਕਿਆਂ ਨਾਲ ਫਸਟਲੀ ਉਹ ਆਪਾਂ ਨੂੰ ਬਹੁਤ ਸਾਰੇ ਕਰੀਅਰਸ ਪ੍ਰੋਵਾਈਡ ਕਰਦੇ ਆ ਕਰੀਅਰ ਓਪਰਚੁਨਿਟੀਸ ਦਿੰਦੇ ਆ ਤਾਂ ਕਿ ਜਿਹੜੇ ਲੋਕ ਅਨਇੰਮਪਲਾਈਡ ਹੈ ਉਹਨਾਂ ਨੂੰ ਕੋਈ ਨਾ ਕੋਈ ਕੰਮ ਮਿਲ ਸਕੇ ਕਿਵੇਂ ਹੁੰਦਾ ਜਿਵੇਂ ਆਪਾਂ ਕੋਈ ਵੀ ਡਿਗਰੀ ਕਰਦੇ ਹਾਂ ਜਿਵੇਂ ਆਪਾਂ ਬੀ ਕੌਮ ਕਰ ਲਈ ਬੀ ਬੀ ਏ ਕਰ ਲਈ ਜਾਂ ਕੋਈ ਬੀ ਏ ਵੀ ਕਰ ਲਈ ਉਸ ਤੋਂ ਬਾਅਦ ਆਪਾਂ ਸੋਚਦੇ ਵੀ ਆਪਾਂ ਕੋਈ ਵੀ ਕੰਪੀਟੀਸ਼ਨ ਇਗਜਾਮ ਕਰੈਕ ਕਰੀਏ ਅਤੇ ਸਭ ਤੋਂ ਪਹਿਲਾਂ ਦਿਮਾਗ ਵਿੱਚ ਆਪਣੇ ਬੈਂਕਿੰਗ ਹੀ ਆਉਂਦੀ ਹੁੰਦੀ ਹੈ ਆਪਣੇ ਐਸ ਐਸ ਸੀ ਜਾਂ ਕੋਈ ਹੋਰ ਮਤਲਬ ਜਿਹੜੇ ਹੁੰਦੀਆਂ ਪੋਸਟਾਂ ਗੌਰਮੈਂਟ ਦੀਆਂ ਉਹ ਤਾਂ ਬਾਅਦ ਵਿੱਚ ਆਪਣੇ ਦਿਮਾਗ 'ਚ ਆਉਂਦੇ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਬੈਕਿੰਗ ਹੀ ਆਉਂਦੀ ਵੀ ਆਪਾਂ ਬੈਂਕਿੰਗ ਦਾ ਪੇਪਰ ਕਰੈਕ ਕਰਦੇ ਹਾਂ ਆਪਣੇ ਬੈਂਕਿੰਗ ਦੇ ਇਗਜ਼ਾਮ ਵੀ ਦੋ ਹੀ ਹੁੰਦੇ ਆ ਐਸ ਬੀ ਆਈ ਦਾ ਅੱਡ ਹੁੰਦਾ ਅਤੇ ਅਦਰਸ ਬੈ ਅਦਰ ਬੈਂਕ ਲਈ ਹੋਰ ਹੁੰਦਾ ਕਿਉਂਕਿ ਐਸ ਬੀ ਆਈ ਆ ਜਿਹੜੀ ਦੁਨੀਆ ਆਪਣੇ ਪੂਰੇ ਇੰਡੀਆ ਦੀ ਨਾ ਬਹੁਤ ਵੱਡੀ ਸਭ ਤੋਂ ਵੱਡੀ ਬਰਾਂਚ ਹੈ ਜਿਹਦੀ ਹਰ ਵੀ ਉਹਦਾ ਮੇਨ ਔਫਿਸ ਇੱਕ ਜਗ੍ਹਾ 'ਤੇ ਹੈ ਪਰ ਜਿਹੜੇ ਬਾਕੀ ਸਾਰੀਆਂ ਸਟੇਟਸ ਹੋ ਗਈਆਂ ਸਟੇਟਸ ਦੇ ਅਗਾਂਹ ਜ਼ਿਲ੍ਹੇ ਹੋ ਗਏ ਅਤੇ ਉਹਨਾਂ ਵਿੱਚ ਸਾਰਿਆਂ ਵਿੱਚ ਆਪਦੇ ਆਪਦੀ ਬਰਾਂਚ ਅਲੱਗ ਅਲੱਗ ਖੁੱਲ੍ਹੀ ਹੋਈ ਹੈ ਐਸ ਬੀ ਆਈ ਸਭ ਤੋਂ ਵੱਡਾ ਬੈਂਕਿੰਗ ਨੈਟਵਰਕ ਹੈ ਅਤੇ ਜਿਹੜਾ ਐਸ ਬੀ ਆਈ ਦਾ ਜਿਹੜਾ ਪੇਪਰ ਕਰੈਕ ਕਰਨਾ ਉਹ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਅਤੇ ਜਿਵੇਂ ਆਪਣੇ ਬਹੁਤ ਸਾਰੇ ਟਾਸਕ ਮਤਲਬ ਲੈਵਲਸ ਹੁੰਦੇ ਆ ਪੇਪਰ ਦੇ ਵੀ ਜਿਵੇਂ ਪਹਿਲਾਂ ਮੇਨਸ ਪ੍ਰੀਲਮਸ ਹੋ ਗਏ ਇੰਟਰਵਿਊ ਦੇਣਾ ਵੀ ਜਿਹੜਾ ਬੱਚਾ ਇਹਨਾਂ ਤਿੰਨਾਂ ਨੂੰ ਪਾਰ ਕਰਕੇ ਆਉਂਦਾ ਇੱਕ ਹਿਸਾਬ ਦਾ ਪੂਰਾ ਐਕਸਪੀਰੀਐਂਸਡ ਬਣ ਜਾਂਦਾ ਕਿਉਂਕਿ ਇੱਕ ਵਾਰ 'ਚ ਬਹੁਤ ਘੱਟ ਲੋਕਾਂ ਦਾ ਕਲੀਅਰ ਹੁੰਦਾ ਦੋ ਦੋ ਅਟੈਮਸ ਤਾਂ ਲੱਗ ਹੀ ਜਾਂਦੀਆਂ ਜਾਂ ਕਈ ਵਾਰ ਦੋ ਤੋਂ ਵੱਧ ਵੀ ਲੱਗ ਜਾਂਦੀਆਂ ਤਾਂ ਇੱਕ ਹਿਸਾਬ ਦਾ ਕੋਲੇ ਦੀ ਖਾਣ 'ਚੋਂ ਹੀਰਾ ਤਰਾਸ਼ਣਾ ਹੀ ਹੁੰਦਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਬੈਂਕਿੰਗ 'ਚ ਨੌਕਰੀ ਮਿਲਦੀ ਆ ਉਹਨਾਂ ਨੂੰ ਟ੍ਰੇਨਿੰਗ ਪ੍ਰੋਗਰਾਮਸ ਪ੍ਰੋਵਾਈਡ ਕੀਤੇ ਜਾਂਦੇ ਆ ਜਿਹਦੇ ਨਾਲ ਕਿ ਉਹਨਾਂ ਨੂੰ ਪ੍ਰੋਪਰ ਕੰਮ ਕਰਨਾ ਸਿਖਾਇਆ ਜਾਂਦਾ ਵੀ ਤੁਸੀਂ ਇੱਥੇ ਬਹਿ ਕੇ ਇਹ ਕੰਮ ਕਰਨਾ ਕੈਸ਼ੀਅਰ ਨੂੰ ਕੈਸ਼ੀਅਰ ਦਾ ਦੂਜਿਆਂ ਨੂੰ ਦੂਜਾ ਕੰਮ ਸਿਖਾਇਆ ਜਾਂਦਾ ਉਸ ਤੋਂ ਇਲਾਵਾ ਇਹ ਜਿਹੜੇ ਬੈਂਕਿੰਗ ਵਾਲੇ ਆ ਹੋਰ ਕਿਵੇਂ ਆਕਰਸ਼ਿਤ ਕਰਦੇ ਆ ਆਪਦੇ ਜਿਵੇਂ ਆਪਦੀ ਸੈਲਰੀ ਨੂੰ ਦੱਸ ਕੇ ਵੀ ਉਹ ਸੈਲਰੀ ਬਹੁਤ ਵਧੀਆ ਦਿੰਦੇ ਆ ਇਸ ਤੋਂ ਇਲਾਵਾ ਜੇ ਕੋਈ ਬੋਨਸ ਵਗੈਰਾ ਉਹ ਵੀ ਦਿੰਦੇ ਆ ਉਹ ਅਤੇ ਇਸ ਤੋਂ ਇਲਾਵਾ ਜਿਹੜੇ ਕਈ ਵਾਰੀ ਉਹ ਸ਼ੇਅਰਸ ਵੀ ਮਤਲਬ ਖਰੀਦਣ ਲਈ ਪੈਸੇ ਦਿੰਦੇ ਆ ਸ਼ੇਅਰਸ ਵੀ ਦਿੰਦੇ ਆ ਉਹ ਅਤੇ ਇਹਦੇ ਨਾਲ ਕਿ ਸ਼ੇਅਰਸ ਨਾਲ ਕਿ ਆਪਾਂ ਬੈਂਕਿੰਗ ਵੈਸੇ ਬੈਂਕਸ ਦੇ ਸ਼ੇਅਰਸ ਹੁੰਦੇ ਆ ਐਚ ਡੀ ਐਫ ਸੀ ਦੇ ਵੀ ਹੁੰਦੇ ਆ ਸ਼ੇਅਰਸ ਉਹਦੇ ਨਾਲ ਕਿ ਆਪਾਂ ਇੱਕ ਹਿਸਾਬ ਦੀ ਇਨਵੈਸਟਮੈਂਟ ਕਰਦੇ ਹਾਂ ਬੈਂਕ 'ਚ ਅਤੇ ਆਪਾਂ ਉਹਦੇ ਹਿੱਸੇਦਾਰ ਬਣ ਜਾਂਦੇ ਹਾਂ ਵੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਬੈਕਿੰਗ ਅਤੇ ਬੀਮਾ ਵਾਲੇ ਪ੍ਰੋਵਾਈਡ ਕਰਦਾ ਜਿਹਦੇ ਨਾਲ ਕਿ ਆਪਦੇ ਆਪ ਨੂੰ ਆਪਦੀ ਗੁੱਡਵਿਲ ਨੂੰ ਵੀ ਮੈਂਟੇਨ ਕਰਦੇ ਅਤੇ ਵੱਧ ਤੋਂ ਵੱਧ ਲੋਕ ਉਹਨਾਂ ਵੱਲ ਆਉਂਦੇ ਐਗੇ